ਹਾਂ ਮੈਂ ਪਿੰਡ ਤੋਂ ਹੀ ਬਿਲੋਂਗ ਕਰਦੀ ਹਾਂ ਅਤੇ ਸਾਡੇ ਆਹ ਸਾਹਮਣੇ ਹੀ ਗਵਾਂਢ ਵਿੱਚ ਇੱਕ ਬਹੁਤ ਹੀ ਪ੍ਰਸਿੱਧ ਭਜਨ ਮੰਡਲੀ ਹੈ ਜਿਸ ਦਾ ਨਾਮ ਹੈ ਰਾਧੇ ਸ਼ਾਮ ਭਜਨ ਮੰਡਲੀ ਸਾਡੇ ਪਿੱਛੇ ਜਿਹੇ ਹੀ ਇੱਕ ਜਗਰਾਤਾ ਕ ਹੋਇਆ ਸੀ ਜਿਸ ਵਿੱਚ ਇਸ ਭਜਨ ਮੰਡਲੀ ਨੇ ਨੇ ਸੰਗੀਤ ਸ਼ੁਰੂ ਕੀਤਾ ਉਸ ਵਿੱਚ ਬਹੁਤ ਸਾਰੇ ਸੰਗੀਤ ਯੰਤਰ ਵਰਤੇ ਉਹਨਾਂ ਨੇ ਜਿਵੇਂ ਹਰਮੋਨੀਅਮ ਤਬਲਾ ਅਤੇ ਫਲਿਊਟ ਹੋਰ ਕਹੀ ਸਾਰੀ ਸੁਰੰਗੀ ਅ ਢੋਲਕੀ ਆਹ ਸਭ ਯੂ ਵਰਤਿਆ ਉਹਨਾਂ ਨੇ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਕਿ ਭਜਨ ਮੰਡਲੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸੰਗੀਤ ਦਾ ਅਰੇਂਜਮੈਂਟ ਕੀਤਾ ਉਹਨਾਂ ਨੇ ਇੰਨਾ ਕੁ ਜ਼ਿਆਦੇ ਵਧੀਆ ਗਾਇਆ ਕਿ ਉੱਥੋਂ ਦੇ ਆਸ ਪਾਸ ਦੇ ਲੋਕ ਆ ਜਿਹੜੇ ਝੂਮ ਉੱਠੇ ਉਹਨਾਂ ਦਾ ਦਿਲ ਖਿੱਚ ਖਿੱਚ ਲਿਆ ਉਹਨਾਂ ਨੇ ਅਤੇ ਉੱਠ ਕੇ ਨੱਚਣ ਲੱਗ ਪਏ ਰਾਤ ਰਾਤ ਤੱਕ ਉਹਨਾਂ ਨੇ ਪੂਰੇ ਸੰਗੀਤ ਨੂੰ ਬਹੁਤ ਹੀ ਜ਼ਿਆਦੇ ਇੰਜੋਏ ਕੀਤਾ ਉਹਨਾਂ ਦੀ ਸੰਗੀਤ ਯੰਤਰ ਇੰਨੇ ਕੁ ਹੀ ਜ਼ਿਆਦਾ ਵਧੀਆ ਸਨ ਕਿ ਇਕੱਲੀ ਤਾਲ ਨਾਲ ਤਾਲ ਮਿਲ ਰਹੀ ਸੀ ਉਹ ਭਜਨ ਮੰਡਲੀ ਇੰਨੀ ਕੁ ਜ਼ਿਆਦੇ ਵਧੀਆ ਸੀ ਕਿ ਦੂਰ ਦੂਰ ਤੱਕ ਮਸ਼ਹੂਰ ਹੋ ਗਈ ਅਤੇ ਉਹ ਜਮਾਂ ਸਾਡੇ ਸਾਹਮਣੇ ਹੀ ਗਵਾਂਡ ਵਿੱਚ ਹੀ ਰਹਿੰਦੇ ਸਨ ਅਸੀਂ ਵੀ ਜਦੋਂ ਕੋਈ ਪੂਜਾ ਪਾਠ ਕੀਤਾ ਤਾਂ ਅਸੀਂ ਵੀ ਉਸੇ ਭਜਨ ਮੰਡਲੀ ਨੂੰ ਹੀ ਆਪਣੇ ਸੰਗੀਤ ਕਰਨ ਨਹੀਂ ਬੁਲਾਇਆ ਉਹਨਾਂ ਕੋਲ ਬਹੁਤ ਹੀ ਸਾਰੇ ਯੰਤਰ ਸੀ ਸੰਗੀਤ ਨਾਲ ਰਿਲੇਟਡ ਅਤੇ ਫਿਰ ਅਸੀਂ ਉਨਾਂ ਹੀ ਭਜਨ ਮੰਡਲੀ ਨੂੰ ਆਪਣੇ ਨਾਲ ਸੰਗੀਤ ਕਰਨ ਲਈ ਬੁਲਾਇਆ ਤਾਂ ਉਹਨਾਂ ਨੇ ਬਹੁਤ ਹੀ ਵਧੀਆ ਸੰਗੀਤ ਸਾਡੇ ਪੂਜਾ ਕੀਤ ਹੋਈ ਸੀ ਤਾਂ ਉਹਨਾਂ ਨੇ ਸਾਡੇ ਵੀ ਬਹੁਤ ਵਧੀਆ ਸੰਗੀਤ ਕੀਤਾ ਅਤੇ ਇਸ ਲਈ ਅਸੀਂ ਉਸ ਭਜਨ ਮੰਡਲੀ ਜਿਹੜੀ ਹੈ ਦੂਰ ਦੂਰ ਤੱਕ ਮਸ਼ਹੂਰ ਹੋ ਗਈ ਅਤੇ ਉਹ ਇਕੱਠੇ ਹੁੰਦੇ ਜਿੱਥੇ ਵੀ ਇਕੱਠੇ ਹੁੰਦੇ ਸਾਰੀ ਸੰਗਤ ਵੀ ਉਹਨਾਂ ਦੇ ਨਾਲ ਖੂਬ ਦਿਲ ਖਚਮ ਹੱਸ ਕੇ ਝੂੰਮਦੀ ਅਤੇ ਉਹਨਾਂ ਦੇ ਨਾਲ ਰਲ ਉੱਠਦੀ ਅਤੇ ਉਹ ਜ਼ੋਰ ਜ਼ੋਰ ਦੀ ਨੱਚਣ ਲੱਗ ਜਾਂਦੇ ਉਹਨਾਂ ਦਾ ਸੰਗੀਤ ਇੰਨਾ ਜ਼ਿਆਦੇ ਵਧੀਆ ਸੀ ਕਿ ਉਹ ਮੈਂ ਸੁਣਿਆ ਹੈ ਕਿ ਉਹ ਬ ਅੰ ਰਾਸ਼ਟਰੀ ਪੱਧਰ 'ਤੇ ਵੀ ਮੁਕਾਬਲਾ ਕਰਨ ਗਏ ਸੀ ਉਹ ਰਾਧੇ ਸ਼ਾਮ ਜਿਹੜੀ ਭਜਨ ਮੰਡਲੀ ਸੀ ਉਹ ਰਾਸ਼ਟਰੀ ਪੱਧਰ 'ਤੇ ਵੀ ਇਨਾਮ ਜਿੱਤ ਕੇ ਲੈ ਕੇ ਆਈ ਹੈ ਉਹਨਾਂ ਨੇ ਬਹੁਤ ਹੀ ਵਧੀਆ ਇੱਕ ਸੰਗੀਤ ਦਾ ਤਾਲ ਸੁਰ ਦੇ ਵਿੱਚ ਵਧੀਆ ਬਣਾਇਆ ਕਿ ਉਹ ਅੱਗੇ ਜਾ ਕੇ ਬਹੁਤ ਹੀ ਵਧੀਆ ਮਸ਼ਹੂਰ ਹੋ ਗਏ ਦੂਰ ਦੂਰ ਤੱਕ ਆਸ ਪਾਸ ਦੇ ਪਿੰਡਾਂ ਦੇ ਲੋਕ ਵੀ ਇਸ ਭਜਨ ਰਾਧੇ ਸ਼ਾਮ ਭਜਨ ਮੰਡਲੀ ਨੂੰ ਬੁਲਾਉਣ ਲੱਗ ਪਏ ਆਪਣੇ ਕੋਲ ਇਸ ਵੀਡੀਓ ਉਹ ਦੂਰ ਦੂਰ ਤੱਕ ਮਸ਼ਹੂਰ ਹੋ ਗਏ ਇਸ ਲਈ ਅਸੀਂ ਰਾਧੇ ਸ਼ਾਮ ਭਜਨ ਮੰਡਲੀ ਨੂੰ ਅਸੀਂ ਕੋਈ ਵੀ ਪੂਜਾ ਪਾਠ ਜਾਂ ਆਸ ਪਾਸ ਰਿਲੇਟਿਵ ਰਿਸ਼ਤੇਦਾਰ ਜਿਨ੍ਹਾਂ ਨੇ ਪੂਜਾ ਪਾਠ ਜਾਂ ਕੋਈ ਵੀ ਜਗਰਾਤਾ ਹੋਵੇ ਤਾਂ ਅਸੀਂ ਇਸ ਹੀ ਰਾਧੇ ਸ਼ਾਮ ਭਜਨ ਮੰਡਲੀ ਨੂੰ ਹੀ ਸੱਦ ਦੇ ਹਾਂ ਅਤੇ ਬਹੁਤ ਹੀ ਵਧੀਆ ਸੰਗੀਤ ਔਰ ਰ ਸਾਜ਼ ਗਾ ਵਾ ਵਰਤਦੇ ਹਨ ਅਤੇ ਤਬਲਾ ਹਰਮੋਨੀਅਮ ਇਸ ਤਰੀਕੇ ਨਾਲ ਵਰਤਦੇ ਹਨ ਅਤੇ ਇਹਨਾਂ ਕੋਲ ਹੋਰ ਵੀ ਬਹੁਤ ਜਾਣੇ ਲੋਕ ਆ ਜਿਹੜੇ ਸਿੱਖਣ ਵੀ ਆਉਂਦੇ ਹਨ ਹਰਮੋਨੀਅਮ ਇਹ ਬਹੁਤ ਹੀ ਵਧੀਆ ਸਿਖਾਉਣ ਆਉਂਦੇ ਹਨ ਲੋਕਾਂ ਨੂੰ ਜਿਹੜਾ ਵੀ ਇਹਨਾਂ ਕੋਲ ਸਿੱਖਣ ਆਉਂਦਾ ਉਹਨਾਂ ਨੂੰ ਵੀ ਆਪਣੇ ਵਰਗੇ ਹੀ ਸੰਗੀਤ ਸੁਰ ਦੇ ਤਾਲ ਦੇ ਵਿੱਚ ਇਹ ਰਸ ਲੈਂਦੇ ਹਨ ਇਸ ਲਈ ਇਹ ਭਜਨ ਮੰਡਲੀ ਬਹੁਤ ਹੀ ਵਧੀਆ ਹੈ ਰਾਧੇ ਸ਼ਾਮ ਅਸੀਂ ਵੀ ਜਦ ਕੋਈ ਪੂਜਾ ਪਾਠ ਕਰਵਾਉਣਾ ਹੈ ਤਾਂ ਇਸੇ ਹੀ ਭਜਨ ਰਾਧੇ ਸ਼ਾਮ ਭਜਨ ਮੰਡਲੀ ਨੂੰ ਹੀ ਬਣਾਉਣ ਬੁਲਾਉਂਦੇ ਹਾਂ